ਮੇਰੇ ਘਰ ਪਾਰਟੀ ਆ ਪਲੀਸ ਸਾਡੀ ਅੱਜ ਮੋਟਰ ਖ਼ਰਾਬ ਹੋ ਗਈ ਆ ਅਤੇ ਮੈਨੂੰ ਪਾਣੀ ਚਾਹੀਦਾ ਵਾ ਕੱਲ੍ਹ ਮੇਰੇ ਘਰ ਪਾਲਟੀ ਆ ਤਾ ਪਰ ਮੋਟਰ ਵਾਲਾ ਕਹਿੰਦਾ ਕਿ ਮੈਂ ਨਹੀਂ ਠੀਕ ਕਰਨ ਆ ਸਕਦਾ ਤਾਂ ਪਲੀਜ਼ ਕੱਲ੍ਹ ਤੇਈ ਦੋ ਦੋ ਹਜ਼ਾਰ ਪੱਚੀ ਨੂੰ ਮੇਰੇ ਘਰ ਪਾਰਟੀ ਆ ਪਲੀਜ਼ ਮੈਨੂੰ ਤੁਸੀਂ ਪਾਣੀ ਵਾਸਤੇ ਟੈਂਕਰ ਭੇਜ ਦਓ ਅਤੇ ਤੁਸੀਂ ਮੈਨੂੰ ਆਪਣਾ ਮੈਂ ਤੁਹਾਨੂੰ ਆਪਣਾ ਡਰੈਸ ਦਿੰਦੀ ਹਾਂ ਅਤੇ ਤੁਸੀਂ ਉਸ ਡਰੈਸ 'ਤੇ ਪਲੀਸ ਮੈਨੂੰ ਪਾਣੀ ਭੇਜੋ ਤੁਸੀਂ ਜੋ ਵੀ ਤੁਹਾਡੇ ਚਾਰਜਸ ਆ ਮੈਨੂੰ ਦੱਸ ਦਓ ਅਤੇ ਪਲੀਜ਼ ਮੇਰੀ ਪਾਲਟੀ ਰੱਖੀ ਹੋਈ ਆ ਤਾਂ ਕੱਲ੍ਹ ਮੇਰੇ ਸਾਰਿਆਂ ਨੇ ਗੈਸਟਾਂ ਨੇ ਆਉਣਾ ਵਾ ਅਤੇ ਪਲੀਜ਼ ਤੁਸੀਂ ਮੈਨੂੰ ਪਾਣੀ ਦੀ ਬਹੁਤ ਜ਼ਰੂਰਤ ਆ ਪਲੀਜ਼ ਪਲੀਜ਼ ਰਿਕੁਐਸਟ ਆ ਮੇਰੇ ਵੱਲੋਂ ਕਿ ਤੁਸੀਂ ਮੈਨੂੰ ਪਾਣੀ ਭੇਜੋ ਅਤੇ ਮੇਰੇ ਕੋਲ ਪਾਣੀ ਦੀ ਬਹੁਤ ਘੱਟ ਰਹਿ ਗਿਆ ਵਾ ਕਿ ਮੈਂ ਅੱਜ ਤਾਂ ਚਲੋ ਕਰ ਲਊਂਗੀ ਅਡਜੈਸਟ ਅਤੇ ਪਰ ਮੇਰੇ ਕੋਲ ਕੱਲ੍ਹ ਐਡਜਸਟ ਹੋਣਾ ਨਹੀਂ ਆ ਤਾਂ ਪਲੀਜ਼ ਤੁਸੀਂ ਮੈਨੂੰ ਇੱਕ ਟੈਂਕਰ ਭੇਜ ਦਓ ਪਾਣੀ ਦਾ ਅਤੇ ਬਾਕੀ ਆਪਣੀ ਪੇਮੈਂਟ ਵਗੈਰਾ ਦੱਸ ਦਓ ਮੈਂ ਤੁਹਾਨੂੰ ਕੈਸ਼ ਦੇ ਦੇਵਾਂਗੀ ਥੈਂਕ ਯੂ